ਹੈਲੋ ਗੁੱਡ ਮੋਰਨਿੰਗ ਸਰ ਸਰ ਮੈਂ ਇੰਦੂ ਬਾਲਾ ਬੋਲ ਰਹੀ ਹਾਂ ਮੈਂ ਐਮਾਜੋਨ 'ਤੇ ਇੱਕ ਆਰਡਰ ਕੀਤਾ ਸੀ ਹਾਂਜੀ ਮੈਨੇ ਇੱਕ ਬੁੱਕਸ ਅਤੇ ਇੱਕ ਸਟੱਡੀ ਟੇਬਲ ਆਰਡਰ ਕੀਤਾ ਸੀ ਅਤੇ ਮੈਂ ਬਸ ਇਹ ਦੱਸਣ ਲਈ ਫੋਨ ਕੀਤਾ ਫੀਡਬੈਕ ਲਈ ਫੋਨ ਕੀਤਾ ਜੀ ਕਿ ਤੁਹਾਡਾ ਜੀ ਮਤਲਬ ਮੈਨੂੰ ਬਹੁਤ ਵਧੀਆ ਲੱਗੀ ਔਨਲਾਈਨ ਸਰਵਿਸ ਜੀ ਮੈਨੇ ਪਹਿਲੀ ਵਾਰ ਆਰਡਰ ਕੀਤਾ ਸੀ ਔਨਲਾਈਨ ਅਤੇ ਮੈਨੂੰ ਨਹੀਂ ਪਤਾ ਸੀ ਵੀ ਇੰਨਾ ਵਧੀਆ ਐਕਸਪੀਰੀਅੰਸ ਰਹੂ ਜੀ ਮੈਨੇ ਜਿਵੇਂ ਸੁਣਿਆ ਸੀ ਬਹੁਤ ਧੋਖੇਧੜੀ ਹੁੰਦੀ ਆ ਜੀ ਬਹੁਤ ਸਕੈਮਸ ਹੁੰਦੇ ਨੇ ਔਨਲਾਈਨ 'ਚ ਜੀ ਪਰ ਨਾ ਜੀ ਤੁਹਾਡੀ ਸਰਵਿਸ ਬਹੁਤ ਜ਼ਿਆਦਾ ਵਧੀਆ ਹੈ ਜੀ ਤੁਹਾਡੀ ਪੈਕਿੰਗ ਵੀ ਪੂਰੀ ਵਧੀਆ ਸੀ ਜੀ ਅਤੇ ਪ੍ਰੋਡਕਟ ਦੀ ਕੁਆਲਿਟੀ ਜੀ ਉਹ ਵੀ ਬਹੁਤ ਵਧੀਆ ਸੀ ਜੀ ਬੁੱਕਸ ਜੀ ਬੁੱਕਸ ਬੁੱਕਸ ਦਾ ਪੇਜਿਸ ਵਗੈਰਾ ਪ੍ਰਿੰਟ ਬਹੁਤ ਜ਼ਿਆਦਾ ਵਧੀਆ ਸੀ ਜੀ ਅਤੇ ਸਟੱਡੀ ਟੇਬਲ ਜੀ ਸਟੱਡੀ ਟੇਬਲ ਦਾ ਮਟੀਰੀਅਲ ਵੀ ਬਹੁਤ ਵਧੀਆ ਸੀ ਜੀ ਮੈਨੂੰ ਤਾਂ ਐਵੇਂ ਸੀ ਇੱਕ ਬਹੁਤ ਘਟੀਆ ਕੁਆਲਿਟੀ ਦੇ ਚੀਜ਼ ਆ ਭੇਜ ਦਿੰਦੇ ਨੇ ਜੀ ਵਧੀਆ ਦਿਖਾ ਕੇ ਪਰ ਨਹੀਂ ਜੀ ਬਿਲਕੁਲ ਕਲਰ ਵੀ ਉਹ ਹੀ ਜੀ ਮਟੀਰੀਅਲ ਵੀ ਉਹ ਹੀ ਜੀ ਅਤੇ ਜੀ ਡਿਲੀਵਰੀ ਵੀ ਤੁਹਾਡੀ ਬਿਲਕੁਲ ਟਾਈਮ 'ਤੇ ਸੀ ਜੀ ਐਵੇਂ ਨਹੀਂ ਸੀ ਸੀਗੀ ਮਤਲਬ ਜਦੋਂ ਲੋੜ ਹੈ ਉਹਦੀ ਮਤਲਬ ਤੁਹਾਡੀ ਚੀਜ਼ ਪਹੁੰਚਦੀ ਹੈ ਜੀ ਹਾਂਜੀ ਅਤੇ ਜੀ ਪ੍ਰੋਡਕਟ ਵੀ ਬਸ ਜੀ ਬਹੁਤ ਵਧੀਆ ਨੇ ਜੀ ਮਤਲਬ ਬਾਕੀਆਂ ਦੇ ਨਹੀਂ ਇੰਨੀ ਸਕੈਮ ਵਗੈਰਾ ਹੁੰਦੇ ਰਹਿੰਦੇ ਨੇ ਔਰ ਉਸ ਹਿਸਾਬ ਨਾਲ ਜੀ ਬਹੁਤ ਵਧੀਆ ਸੀ ਅਤੇ ਮੈਨੂੰ ਬਹੁਤ ਵਧੀਆ ਐਕਸਪੀਰੀਅੰਸ ਰਿਹਾ ਜੀ ਮੈਨੂੰ ਪਹਿਲੀ ਵਾਰ ਜਦੋਂ ਔਨਲਾਈਨ ਸ਼ੌਪਿੰਗ ਕੀਤੀ ਹੈ ਜੀ ਤੁਹਾਡੀ ਐਪ ਤੋਂ ਜੀ ਹਾਂਜੀ